ਹਾਂਜੀ ਅਗਰ ਗੱਲ ਕਰੀਏ ਮਨਪਸੰਦ ਬਾਈਕਾਂ ਦੀ ਤਾਂ ਸਭ ਤੋਂ ਮਨਪਸੰਦ ਬਾਈਕ ਆ ਮੇਰੀ ਬੁਲਟ ਸਪਲੈਂਡਰ ਐਂਡ ਪਲੈਟੀਨਾ ਔਰ ਜੇ ਮਨਪਸੰ ਇਹਨਾਂ ਦੇ ਵਿੱਚੋਂ ਤਾਂ ਮੇਰੀ ਫੇਵਰੇਟ ਮੰਨਿਆ ਜਾਵੇ ਤਾਂ ਉਹ ਹੈਗਾ ਬੁਲਟ ਬੁਲਟ ਪਰ ਮੈਂ ਬਹੁਤ ਜ਼ਿਆਦਾ ਲਾਈਕ ਕਰਦਾ ਔਰ ਮੈਨੂੰ ਪਸੰਦ ਵੀ ਉਸ ਉਸਦਾ ਕਾਰਨ ਕੀ ਹੈ ਉਹਦਾ ਕਾਰਨ ਇੱਕ ਤਾਂ ਉਸਦੀ ਆਵਾਜ਼ ਇੱਕ ਉਸਦੀ ਪਿੱਕਅੱਪ ਇੱਕ ਉਸਦਾ ਸੰਤੁਲਨ ਜਦੋਂ ਉਹਨੂੰ ਚਲਾਉਂਦੇ ਹਾਂ ਤਾਂ ਉਹ ਬਹੁਤ ਹੀ ਜ਼ਿਆਦਾ ਆਰਾਮਦਾਇਕ ਹੈ ਕਈ ਵਾਰ ਅਸੀਂ ਪਹਾੜਾਂ ਦੇ ਉੱਪਰ ਵੀ ਗਏ ਹਾਂ ਬਾਈਕ ਲੈ ਕੇ ਜਿਵੇਂ ਹੇਮਕੁੰਟ ਸਾਹਿਬ ਹੋ ਗਿਆ ਉੱਥੇ ਮੈਂ ਦੋ ਵਾਰ ਯਾਤਰਾ ਕਰਕੇ ਆਇਆ ਨਾਲ ਮੇਰੇ ਦੋਸਤ ਹੁੰਦੇ ਸੀਗੇ ਮੇਰਾ ਦੋਸਤ ਗੁਰਬਾਹਰ ਜੋ ਅੱਜ ਕੱਲ੍ਹ ਆਸਟਰੇਲੀਆ ਦੇ ਵਿੱਚ ਬੈਠਾ ਹੈ ਉਹ ਵੀ ਸ਼ਾਇਦ ਮੈਨੂੰ ਸੁਣਦਾ ਹੋਵੇ ਔਰ ਇੱਕ ਵਾਰ ਗਏ ਸੀ ਅਸੀਂ ਸ਼ਿਮਲੇ ਸ਼ਿਮਲੇ ਗਏ ਸੀ ਅਸੀਂ ਅ ਬ ਹੇਮਕੁੰਟ ਸਾਹਿਬ ਗਏ ਸੀਗੇ ਅਸੀਂ ਬੁਲਟ 'ਤੇ ਸ਼ਿ ਅ ਤਾਂ ਸ਼ਿਮਲੇ ਗਏ ਸੀਗੇ ਅਸੀਂ ਪਲੈਟੀਨਾ 'ਤੇ ਪਲੈਟੀਨਾ 'ਤੇ ਸਾਡੀ ਬਹੁਤ ਹਾਸੋ ਹੀਣੀ ਘਟਨਾ ਹੋਈ ਕਾਲਕਾ ਤੋਂ ਅੱਗੇ ਸਾਡਾ ਮੋਟਰਸਾਈਕਲ ਉੱਪਰ ਨੂੰ ਜਾਏ ਹੀ ਨਾ ਉਸਦੀ ਜਾਂ ਤਾਂ ਉਸਦਾ ਤੇਲ ਘਟਾਇਆ ਵਾ ਸੀਗਾ ਮਿਸਤਰੀ ਨੇ ਜਾਂ ਕੋਈ ਹੋਰ ਕਾਰਨ ਹੋ ਸਕਦਾ ਪਰ ਉਹ ਸਾਡੀ ਬਾਈਕ ਅੱਗੇ ਤੁਰੇ ਹੀ ਨਾ ਫਿਰ ਅਸੀਂ ਕਾਲਕਾ ਮੋਟਰਸਾਈਕਲ ਖੜ੍ਹਾ ਕੇ ਉਸ ਤੋਂ ਬਾਅਦ ਅਸੀਂ ਜਿਹੜਾ ਸਫ਼ਰ ਕੀਤਾ ਸੀਗਾ ਸ਼ਿਮਲੇ ਤੋਂ ਕੀਤਾ ਸੀਗਾ ਬੱਸ 'ਤੇ ਅਤੇ ਬੁਲਟ ਬ ਇੱਦਾਂ ਦੀ ਇੱਕ ਹੋ ਆ ਬਾਈਕ ਆ ਉਸ ਨੂੰ ਤੁਸੀਂ ਚਾਹੇ ਪਹਾੜਾਂ 'ਤੇ ਲੈ ਜੋ ਚਾਹੇ ਜਮੀਨੀ ਪੱਧਰ 'ਤੇ ਲੈ ਜੋ ਜਿੱਧਰ ਮਰਜ਼ੀ ਲੈ ਜਾਓ ਉਹ ਹਰ ਵਕਤ ਕਾਮਯਾਬ ਆ ਇਸ ਕਰਕੇ ਮਨਪਸੰਦ ਬਾਈਕ ਮੇਰੀ ਮੈਂ ਬੁਲਟ ਨੂੰ ਹੀ ਮੰਨਦਾ ਹਾਂ